ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕੁਝ ਆਮ ਗਲਤੀਆਂ ਕੀ ਹਨ ਜੋ ਲੋਕ ਉਦੋਂ ਕਰਦੇ ਹਨ ਜਦੋਂ ਉਹ ਪਹਿਲੀ ਵਾਰ ਚਿੱਤਰਕਾਰੀ ਸ਼ੁਰੂ ਕਰਦੇ ਹਨ ਅਤੇ ਉਹ ਉਹਨਾਂ ਤੋਂ ਕਿਵੇਂ ਬਚ ਸਕਦੇ ਹਨ ਇੱਕ ਚੰਗਾ ਕਲਾਕਾਰ ਬਣਨ ਲਈ ਕਿੰਨੇ ਅਭਿਆਸ ਲੋੜ ਹੈ ਇਹ ਜਦੋਂ ਵੀ ਕੋਈ ਚਿੱਤਰਕਾਰ ਜਾਂ ਨਵਾਂ ਲੋਕ ਕੋਈ ਚਿੱਤਰਕਾਰ ਬਣਾਉਣਾ ਸ਼ੁਰੂ ਕਰਦਾ ਜੋ ਕਿ ਉਹਦੀ ਪੈਂਸਲ ਦਾ ਫੜਨਾ ਸਹੀ ਢੰਗ ਨਾਲ ਨਾ ਫੜਨਾ ਜਾਂ ਫਿਰ ਕੋਈ ਵੀ ਕਲਰ ਜਿੱਥੇ ਮੈਚ ਨਾ ਕਰਦਾ ਹੋਵੇ ਉਹ ਕਰਨਾ ਇਹੋ ਜਿਹੀਆ ਗਲਤੀਆਂ ਕਰਦਾ ਹੈ ਅਤੇ ਉਹਨਾਂ ਨੂੰ ਚੰਗਾ ਕਲਾਕਾਰ ਬਣਨ ਲਈ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ ਆਪਣੀ ਪੈਨਸਲ ਫੜਨ ਜਾਂ ਫਿਰ ਕਲਰ ਦੇ ਦੇਖਣ 'ਤੇ ਵੀ ਕਲਰ ਕਿਹੜਾ ਉਰੇ ਸ਼ੂਟ ਕਰਦਾ ਸੋਚ ਸਮਝਦਾਰੀ ਸਮਝਦਾਰੀ ਦੇ ਨਾਲ ਕੰਮ ਕਰਨ ਕਰਨਾ ਪਊਗਾ ਜੋ ਕਿ ਉਹਨੂੰ ਇਹ ਚੀਜ਼ਾਂ ਕਰਨ ਲਈ ਉਹ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਹਨ ਜਾਂ ਫਿਰ ਪੈਨਸਲ ਦੇ ਲੈਂਨਿੰਗ ਹੋ ਗਈ ਕੁਛ ਵੀ ਹੋ ਗਿਆ ਉਹ ਜਮਾਂ ਸਹੀ ਤਰੀਕੇ ਦੇ ਨਾਲ ਚੱਲਣਾ ਹੀ ਇੱਕ ਇੱਕ ਚਿੱਤਰਕਾਰੀ ਦੀ ਚਿੱਤਰਕਾਰੀ ਵਾਸਤੇ ਬਹੁਤ ਜ਼ਰੂਰੀ ਹੈ